ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਸਾਡੇ ਘਰ ਵਿੱਚ ਗੁੜੀਆਂ ਦੀ ਬਰਡੇ ਪਾਰਟੀ ਸੀ ਅਸੀਂ ਉਹਦੇ ਵਾਸਤੇ ਖਾਣਾ ਆਰਡਰ ਕੀਤਾ ਸੀ ਪਾਰਟੀ ਕਰਨ ਵਾਸਤੇ ਬੱਚਿਆਂ ਨੇ ਛੋਲੇ ਭਟੂਰੇ ਇਸ ਤਰ੍ਹਾਂ ਦੀਆਂ ਕੁਝ ਦੋ ਤਿੰਨ ਸਬਜ਼ੀਆਂ ਕੀਤੀਆਂ ਸੀ ਔਰ ਮਠਿਆਈ ਕੇਕ ਗੁਲਾਬ ਜਾਮੁਨ ਰਸਗੁਲੇ ਵੀ ਆਰਡਰ ਕੀਤੇ ਸੀ ਬਾਕੀ ਸਭ ਤਾਂ ਵਧੀਆ ਸੀ ਪਰ ਸਰ ਜਿਹੜੇ ਛੋਲੇ ਭਟੂਰੇ ਸੀ ਨਾ ਉਹਨਾਂ ਦੇ ਵਿੱਚ ਮਸਾਲੇ ਬਹੁਤ ਜ਼ਿਆਦਾ ਤੇਜ਼ ਸੀਗੇ ਜਿਹੜੇ ਬੱਚਿਆਂ ਨੇ ਪਸੰਦ ਨਹੀਂ ਕੀਤੇ ਵੱਡੇ ਵੀ ਜਿਹੜੇ ਉਹ ਇੰਨਾਂ ਜ਼ਿਆਦਾ ਬੀਪੀ ਵਗੈਰਾ ਵਧਣ ਦੇ ਕਰਕੇ ਜ਼ਿਆਦਾ ਮਸਾਲੇ ਨਹੀਂ ਪਸੰਦ ਕਰਦੇ ਉਹਨਾਂ ਇਸ ਕਰਕੇ ਉਹ ਨਹੀਂ ਚੰਗੇ ਲੱਗੇ ਅਸੀਂ ਉਹ ਵਾਪਸ ਕਰਨ ਕੀਤੇ ਸੀ ਲੇਕਿਨ ਸਾਨੂੰ ਹਜੇ ਤੱਕ ਪੈਸੇ ਨਹੀਂ ਵਾਪਸ ਆਏ ਇਸ ਇਸ ਕਰਕੇ ਮੈਂ ਕੰਪਲੇਨ ਕਰਨਾ ਚਾਹੁੰਦੀ ਹਾਂ ਕਿ ਸਾਡੇ ਜਲਦੀ ਤੋਂ ਜਲਦੀ ਸਰ ਜਿਹੜੇ ਪੈਸੇ ਆ ਉਹ ਵਾਪਸ ਭੇਜੇ ਲੈਣ ਬਾਕੀ ਸਰ ਸਭ ਠੀਕ ਸੀਗਾ ਆਪਾਂ ਸਿਰਫ ਸਬਜ਼ੀਆਂ ਨਹੀਂ ਸੀ ਠੀਕ ਸਹੀ ਠੀਕ ਹੈ ਸਰ ਉਕੇ ਸਰ